ਸਤਿ ਸ਼੍ਰੀ ਅਕਾਲ ਜੀ ਤੁਸੀਂ ਜੈਸਮੀਨ ਦੀਦੀ ਬੋਲ ਰਹੇ ਹੋ ਮੈਂ ਹਰਮਨਜੀਤ ਕੌਰ ਬੋਲ ਰਹੀ ਸੀ ਮੇਰਾ ਫਸਟ ਈਅਰ ਹੈ ਕੋਲਜ ਦੇ ਵਿੱਚ ਮੈਂ ਕੈਰਲਾ ਤੋਂ ਇਥੇ ਪੜ੍ਹਨ ਆਉਣਾ ਸੀਗਾ ਤਾਂ ਕਰਕੇ ਮੈਂ ਪੁੱਛ ਰਹੀ ਸੀਗੀ ਵੀ ਇਥੇ ਤੁਸੀਂ ਮੈਨੂੰ ਕੋਲਜ ਦੇ ਨੇੜੇ ਤੇੜੇ ਜਿੰਨੇ ਵੀ ਇਲਾਕਾ ਉਥੋਂ ਦੇ ਵਾਤਾਵਰਨ ਦਾ ਮਾਹੌਲ ਸਾਰਾ ਦੱਸ ਸਕਦੇ ਹੋ ਨਹੀਂ ਜੀ ਅੱਜ ਲੈਣਾ ਹਾਂਜੀ ਠੀਕ ਹੈ ਅਤੇ ਹੋਰ ਜਿੱਦਾਂ ਲੋੜ ਦਾ ਸਮਾਨ ਜਿਹੜਾ ਹੋਵੇਗਾ ਇੱਥੇ ਨੇੜੋ ਤੇੜੋ ਮਿਲ ਜੂਗਾ ਮੌਸਮ ਦੇ ਹਿਸਾਬ ਦੇ ਨਾਲ ਜਿੱਦਾਂ ਕੋਟੀਆਂ ਜੈਕਟਾਂ ਹਾਂਜੀ ਹਾਂਜੀ ਠੀਕ ਹੈ ਅਤੇ ਕੋਈ ਖਾਸ ਚੀਜ਼ ਲੈ ਕੇ ਆਉਣ ਦੀ ਲੋੜ ਹੋਵੇ ਕੋਈ ਜੇ ਖਾਸ ਚੀਜ਼ ਲੈ ਕੇ ਆਉਣੀ ਹੋਵੇ ਇੱਥੋਂ ਦੀ ਜੋ ਇਧਰ ਨਾ ਮਿਲਦੀ ਹੋਵੇ ਜਿਦਾਂ ਕੋਈ ਰਜਾਈਆਂ ਵਗੈਰਾ ਵੀ ਲੈ ਕੇ ਆਉਣੀਆਂ ਪੈਣਗੀਆਂ ਹਾਂਜੀ ਠੀਕ ਹੈ ਜੀ ਬਸ ਆਹੀ ਪਤਾ ਕਰਨਾ ਸੀਗਾ ਦੀਦੀ ਸਤਿ ਸ਼੍ਰੀ ਅਕਾਲ ਜੀ